ਅੱਜ ਕੱਲ੍ਹ ਕਿਸੇ ਵੀ ਛੋਟੀ ਤੋਂ ਛੋਟੀ ਪ੍ਰੋਬਲਮ ਲਈ ਆਪਾਂ ਬਹੁਤ ਜ਼ਿਆਦਾ ਸਟਰੈਸ ਲੈ ਲੈਂਦੇ ਹਾਂ ਅਤੇ ਇਹ ਇੱਕ ਚੰਗੇ ਡਾਕਟਰ ਦੀ ਚੋਣ ਕਰਨਾ ਬਹੁਤ ਜ਼ਿਆਦਾ ਅੱਜ ਕੱਲ੍ਹ ਇੱਕ ਚੈਲੇਜ਼ ਹੋ ਗਿਆ ਸੋ ਇਸ ਚੀਜ਼ ਨੂੰ ਓਵਰਕਮ ਕਰਨ ਦੇ ਲਈ ਟੈਕਨੋਲਜੀ ਨੇ ਇਹਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਹੁਣ ਤੁਸੀਂ ਘਰ ਬੈਠੇ ਕਿਸੇ ਵੀ ਚਾਹੇ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਪ੍ਰੋਬਲਮ ਦੇ ਸਪੈਸ਼ਲਿਸਟ ਨੂੰ ਘਰ ਬੈਠੇ ਹੀ ਉਹਦਾ ਐਕਸਪੀਰੀਅੰਸ ਅਤੇ ਉਸ ਡਾਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਉਹਦਾ ਉਹਦੀ ਫੀਡਬੈਕ ਕੀ ਹੈ ਉਹ ਵੀ ਤੁਹਾਨੂੰ ਮਿਲ ਸਕਦੀ ਹੈ ਠੀਕ ਹੈ ਸੋ ਇਸ ਚੀਜ਼ ਬਾਰੇ ਤੁਹਾਨੂੰ ਕਿਤੇ ਥਾਂ 'ਤੇ ਜਾਂ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ ਤੁਸੀਂ ਆਰਾਮ ਨਾਲ ਆਪਣੇ ਮੋਬਾਇਲ ਦੇ ਵਿੱਚ ਕਿਸੇ ਵੀ ਪਰਟੀਕੁਲਰ ਡਾਕਟਰ ਬਾਰੇ ਜਿਹਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਆਰਾਮ ਨਾਲ ਘਰ ਬੈਠੇ ਹੀ ਮਿਲ ਜਾਂਦੀ ਹੈ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟੈਕਨੋਲਜੀ ਨੇ ਸਾਡੀਆਂ ਡਾਕਟਰੀ ਲੋੜਾਂ ਨੂੰ ਪੂਰਾ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਹੈ ਇਸੇ ਤਰ੍ਹਾਂ ਹੀ ਜੇਕਰ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਹੀਂ ਕੰਫਰਟੇਬਲ ਜਾਣ ਦੇ ਲਈ ਨਹੀਂ ਅਵੇਲੇਬਲ ਹੋ ਕਿ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਈਜ਼ੀਲੀ ਜਾ ਸਕੋ ਤਾਂ ਤੁਸੀਂ ਘਰ ਬੈਠੇ ਵੀ ਔਨਲਾਈਨ ਅਪੁਆਇੰਟਮੈਂਟ ਜਾਂ ਔਨਲਾਈਨ ਡਾਕਟਰ ਦੀ ਸਲਾਹ ਲੈ ਸਕਦੇ ਹੋ ਸੋ ਇਹ ਸਾਰਾ ਕੁਛ ਸੰਭਵ ਹੋਇਆ ਹੈ ਟੈਕਨੋਲਜੀ ਦੇ ਨਾਲ ਹੀ ਤਾਂ ਤੁਸੀਂ ਡਾਕਟਰ ਦੇ ਨਾਲ ਕੰਨਸਰਨ ਕਰਨਾ ਚਾਹੁੰਦੇ ਹੋ ਡਾਕਟਰ ਨਾਲ ਕੰਨਸਲਟ ਕਰ ਸਕਦੇ ਹੋ ਘਰ ਬੈਠੇ ਹੀ ਔਨਲਾਈਨ ਅਪੁਆਇੰਟਮੈਂਟ ਲੈ ਸਕਦੇ ਹੋ ਜਾਂ ਤੁਸੀਂ ਕਿਸੇ ਚਾਹੇ ਪੀ ਜੀ ਆਈ ਜਾਣਾ ਅੱਜ ਕੱਲ੍ਹ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਠੀਕ ਹੈ ਸੋ ਬੰਦਾ ਪ੍ਰੈਫਰ ਕਰਦਾ ਹੈ ਕਿ ਆਪਣਾ ਘੱਟ ਤੋਂ ਘੱਟ ਟਾਈਮ ਕੰਜ਼ਮ ਕੰਜਮਸ਼ਨ ਹੋਵੇ ਸੋ ਬੰਦਾ ਘਰ ਬੈਠਾ ਇਹ ਅਪੁਆਇੰਟਮੈਂਟ ਲੈ ਲੈਂਦਾ ਹੈ ਅਤੇ ਉਹ ਇਜ਼ੀਲੀ ਉਸ ਡਾਕਟਰਾਂ ਨੂੰ ਮਿਲ ਸਕਦਾ ਜਾਂ ਫਿਰ ਔਨਲਾਈਨ ਅਪੁਆਇੰਟਮੈਂਟ ਲੈ ਸਕਦਾ ਸੋ ਟੈਕਨੋਲਜੀ ਇਸ ਚੀਜ਼ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾ ਰਹੀ ਹੈ